ਜੀ ਸਾਡੇ ਪ੍ਰਤਾਪ ਨਗਰ ਏਰੀਏ ਦੀ ਲੈਟ ਕਾਫ਼ੀ ਟੈਮ ਤੋਂ ਬੰਦ ਹੈ ਇਹਦਾ ਕੋਈ ਸੁਝਾਓ ਕੱਢੋ ਅਤੇ ਸਾਡਾ ਇੱਥੇ ਫਰਿਜ 'ਚ ਕੂਲਿੰਗ ਸਾਰੀ ਖਤਮ ਹੋਗੀ ਜੋ ਸਮਾਨ ਪਿਆ ਉਹ ਖਰਾਬ ਵੀ ਹੋ ਸਕਦਾ ਸਾਡਾ ਖਰਾਬ ਹੋ ਰਿਹਾ ਵਾ ਬੱਚਿਆਂ ਦੇ ਪੜ੍ਹਨ ਲਈ ਲੈਟ ਨਹੀਂ ਹੈਗੀ ਬੱਚਿਆਂ ਨੂੰ ਪੜ੍ਹਨ ਲਈ ਦਿੱਕਤ ਹੋ ਰਹੀ ਹੈ ਅਤੇ ਕਾਫ਼ੀ ਟੈਮ ਤੋਂ ਲੈਟ ਨਹੀਂ ਆ ਰਹੀ ਹੈਗੀ ਇਹਦਾ ਕੋਈ ਸੁਝਾਓ ਕੱਢੋ ਅਤੇ ਮੈਨੂੰ ਜਲਦੀ ਤੋਂ ਜਲਦੀ ਇਹਦੀ ਰਿਪੋਰਟ ਦੇਵੋ ਜੀ ਲੈਟ ਕਦ ਤੱਕ ਠੀਕ ਹੋਏਗੀ ਕਦ ਤੱਕ ਨਹੀਂ ਠੀਕ ਹੋਏਗੀ ਮੈਨੂੰ ਕੁਛ ਵੀ ਹੈ ਇਹਦਾ ਦੱਸੋ ਜੀ ਅਤੇ ਅਸੀਂ ਬਹੁਤ ਪ੍ਰੇਸ਼ਾਨ ਹਾਂ ਲਾਈਟ ਨਹੀਂ ਹੋਣ ਕਰਕੇ ਅਸੀਂ ਬਹੁਤ ਪ੍ਰੇਸ਼ਾਨ ਹੈਗੇ ਹਾਂ ਲੈਟ ਨਾ ਹੋਵੇ ਘਰ 'ਚ ਨ੍ਹੇਰਾ ਨ੍ਹੇਰਾ ਹੋਇਆ ਪਿਆ ਸਾਡੀਆਂ ਚੀਜ਼ਾਂ ਸਾਡੀਆਂ ਉਹ ਖਰਾਬ ਹੋ ਰਹੀਆਂ ਨੇ ਬਹਿਣ ਉੱਠਣ ਨੂੰ ਸਾਡੀ ਦਿੱਕਤ ਹੋ ਰਹੀ ਹੈ ਜੀ ਬਜ਼ੁਰਗ ਬੰਦੇ ਘਰੇ ਨੇ ਲੈਟ ਦਾ ਕੋਈ ਸੁਲਝਾਓ ਕੱਢੋ ਲਾਈਟ ਬਹੁਤ ਖਰ ਤੰਗ ਕਰ ਰਹੀ ਹੈ ਸਾਨੂੰ ਆ ਰਹੀ ਹੈ ਜਾ ਰਹੀ ਹੈ ਹੁਣ ਤਾਂ ਤੁਸੀਂ ਕਾਫ਼ੀ ਟੈਮ ਤੋਂ ਆ ਨਹੀਂ ਰਹੀ